ਹੈਲੋ ਸਤਿ ਸ਼੍ਰੀ ਅਕਾਲ ਜੀ ਕਿਆ ਹਾਲ ਹੈ ਹਾਂਜੀ ਹਾਂਜੀ ਅੱਛਾ ਜੀ

ਹਾਂਜੀ ਪ੍ਰੀਤ ਪੈਲਸ ਹੈ ਨਾ ਜਿਹੜਾ ਉਹ ਰੈਸਟੋਰੈਂਟ ਹੈ ਮਤਲਬ ਬਹੁਤ ਵਧੀਆ ਏ ਉੱਥੇ ਤੁਸੀਂ ਆਪਣਾ ਜਾ ਕੇ ਖਾਣਾ ਖੂਣਾ ਖਾ ਸਕਦੇ ਹੋ ਕਾਫੀ ਤਰ੍ਹਾਂ ਦੀ ਤੁਹਾਨੂੰ ਆਈਟਮ ਹੈ ਜਿਹੜੀਆਂ ਉਹ ਮਿਲੂਗੀਆਂ ਵਧੀਆ ਕੁਆਲਿਟੀ ਦੇ ਵਿੱਚ ਮਿਲੂਗੀਆਂ ਤਰ੍ਹਾਂ ਤਰ੍ਹਾਂ ਦੇ ਜਿਵੇਂ ਕਿ ਨੋਨ ਵੈਜ ਜਿੱਦਾਂ ਵੀ ਤੁਹਾਨੂੰ ਚਾਹੀਦਾ ਉਸ ਤਰ੍ਹਾਂ ਦੇ ਹਾਂਜੀ ਹਾਂਜੀ ਹਾਂਜੀ ਅਗਰ ਤੁਸੀਂ ਇਹਨਾਂ ਨੂੰ ਕਹੋਗੇ ਵੀ ਅਲੱਗ ਉਹਨਾਂ ਨੂੰ ਵੈਜ ਬਣਾ ਕੇ ਦੇ ਦਿਉ ਤੁਹਾਨੂੰ ਅਲੱਗ ਜਗ੍ਹਾ ਅਲੱਗ ਹੀ ਵੈਜ ਫੂਡ ਪ੍ਰੋਵਾਈਡ ਕਰੂਗੇ ਹਾਂਜੀ ਹਾਂਜੀ ਸਫ਼ਾਈ ਬਹੁਤ ਵਧੀਆ ਏ ਕਾਫੀ ਹੀ ਹਾਈਜੀਨਕ ਤਰੀਕੇ ਨਾਲ ਉਹ ਖਾਣਾ ਬਣਾਉਂਦੇ ਹੈ ਉਹਨਾਂ ਦੀ ਰੂਮ ਸਰਵਿਸ ਵੀ ਬਹੁਤ ਵਧੀਆ ਏ ਰੂਮਸ ਇੱਕ ਨੰਬਰ ਵਨ ਹੈ ਹਰ ਚੀਜ਼ ਬਹੁਤ ਵਧੀਆ ਏ ਹਾਂਜੀ ਨਹੀਂ ਖਾਣਾ ਜਿਵੇਂ ਵੀ ਤੁਹਾਡੀ ਰਿਕੁਆਇਰਮੈਂਟ ਤੁਹਾਨੂੰ ਸਪਾਈਸੀ ਚਾਹੀਦਾ ਘੱਟ ਸਪਾਈਸੀ ਚਾਹੀਦਾ ਉਹ ਉਸ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਊਂਗੇ ਹਾਂਜੀ ਅਤੇ ਉਹਨਾਂ ਦੀ ਰੂਮ ਸਰਵਿਸ ਬਹੁਤ ਅੱਛੀ ਏ ਟਵੰਟੀ ਫ਼ੋਰ ਆਰਸ ਚੱਲਦੀ ਏ ਉਹਨੀ ਹੋਟਲ ਦੀ ਸਰਵਿਸ ਜਦੋਂ ਵੀ ਤੁਹਾਨੂੰ ਨੀਡ ਹੈ ਤੁਸੀਂ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਾਂਜੀ ਹੋਰ ਹੋਰ ਕੋਈ ਹੈਲਪ ਕਰ ਸਕਾਂ ਹਾਂਜੀ ਰੈਂਟ ਵੀ ਬਸ ਹਾਂਜੀ ਵਨ ਡੇ ਦਾ ਰੈਂਟ ਹੈਗਾ ਏ ਥਾਉਸੰਡ ਰੁਪੀਸ ਬਾਕੀ ਜਿਹੜੇ ਰੈਸਟੂਰੈਂਟ ਆਲ਼ੇ ਦੁਆਲੇ ਹੈ ਹੋਟਲ ਏ ਉਹਨਾਂ 'ਚ ਕਾਫੀ ਜਿਹੜਾ ਰੈਂਟ ਏ ਪਰ ਇਹਨਾਂ ਦੇ ਹੋਟਲ ਦਾ ਰੇਟ ਏ ਜਿਹੜਾ ਬਹੁਤ ਘੱਟ ਹੈ ਹਾਂਜੀ ਹਾਂਜੀ ਕੋਈ ਨਹੀਂ ਕੋਈ ਦਿੱਕਤ ਹੋਈ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਠੀ ਠੀਕ ਏ